ਹਾਂਜੀ ਮੈਨੂੰ ਸੁਰਜੀਤ ਪਾਤਰ ਬਹੁਤ ਪਸੰਦ ਹਨ ਕਿਉਂਕਿ ਉਹਨਾਂ ਦਾ ਸੁਭਾਅ ਬਹੁਤ ਮਿਲਣਸਾਰ ਹੈ ਜਦੋਂ ਵੀ ਕੋਈ ਉਹਨਾਂ ਨੂੰ ਮਿਲਣ ਜਾਂਦਾ ਹੈ ਤਾਂ ਉਹ ਇਨਸਾਨ ਨਾਲ ਬਹੁਤ ਵਧੀਆ ਤਰੀਕੇ ਨਾਲ ਗੱਲ ਕਰਦੇ ਹਨ ਉਸੇ ਤਰ੍ਹਾਂ ਹੀ ਘੁੱਲ ਮਿਲ ਜਾਂਦੇ ਹਨ ਉਹਨਾਂ ਨੂੰ ਪੰਜਾਬੀ ਪੰਜਾਬੀ ਵਿੱਚ ਕਵਿਤਾਵਾਂ ਦਾ ਪ੍ਰਸਿੱਧ ਕਵੀ ਮੰਨਿਆ ਜਾਂਦਾ ਹੈ ਉਹਨਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਹਨ ਅਤੇ ਉਹਨਾਂ ਦੀਆਂ ਲਿਖ ਲਿਖਤਾਂ ਨੇ ਜੋ ਸਾਡੇ ਸਮਾਜ ਨੂੰ ਕੁਝ ਨਾ ਕੁਝ ਸੇਧ ਦਿੰਦੀਆਂ ਹਨ ਉਹਨਾਂ ਨੂੰ ਲੋਕ ਬਹੁਤ ਪਸੰਦ ਕਰਦੇ ਹਨ ਉਹਨਾਂ ਦੀਆਂ ਕਵਿਤਾਵਾਂ ਸਾਡੇ ਸਮਾਜ ਨੂੰ ਅਤੇ ਸਾਡੇ ਜੋ ਨੌਜਵਾਨ ਪੀੜ੍ਹੀ ਉਹਨਾਂ ਨੂੰ ਬਹੁਤ ਵਧੀਆ ਜੋ ਹੈ ਮਤਲਬ ਸੰਦੇਸ਼ ਦਿੰਦੀਆਂ ਹਨ ਜੇ ਅਸੀਂ ਗੱਲ ਕਰੀਏ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਕਵਿਤਾਵਾਂ ਬਾਰੇ ਤਾਂ ਉਹਨਾਂ ਦੀਆਂ ਕੁਛ ਪੁਸਤਕਾਂ ਹਨ ਜਿਹਨਾਂ ਵਿੱਚ ਹਵਾ ਵਿੱਚ ਲਿਖੇ ਹਰਫ ਬਿਰਖ ਅਰਜ ਕਰੇ ਹਨੇਰੇ ਵਿੱਚ ਸੁਲਗਦੀ ਵਰਨਮਾਲਾ ਲਫਜ਼ਾਂ ਦੀ ਪ੍ਰਗਾ ਪੱਤਝੜ ਦੀ ਪੰਜੇਬ ਸੁਰਜਨੀ ਅਨੁਵਾਦ ਕੀਤੇ ਨੇ ਉਹਨਾਂ ਨੇ ਦੁੱਖ ਕਿਤਾਬਾਂ ਜਿਵੇਂ ਕਿ ਅੱਗ ਦੇ ਕਲੀਰੇ ਹੁਕਮ ਦੀ ਹਵੇਲੀ ਵਾਰਤਕ ਸੂਚ ਮੰਦਰ ਦੀਆਂ ਪੌੜੀਆਂ ਇਹ ਬਾਤ ਨੇਰੀ ਇੰਨੀ ਹੀ ਨਹੀਂ ਸਨਮਾਨ ਸੁਰਜੀਤ ਪਾਤਰ ਜੀ ਨੂੰ ਉੱਨੀ ਸੌ ਤ੍ਰਿਆਨਵੇਂ ਵਿੱਚ ਹਨੇਰੇ ਵਿੱਚ ਸੁਲਗਦੀ ਵਰਨਮਾਲਾ ਲਈ ਸਾਹਿਤ ਅਕਾਦਮੀ ਸਨਮਾਨ ਮ ਮਿਲਿਆ ਉੱਨੀ ਸੌ ਸਤਾਨਵੇਂ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਸਨਮਾਨ ਪੰਜਨਵ ਪੁਰਸਕਾਰ